ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜਨੀ ਹੈ ਅਤੇ ਮੈਂ ਪਠਾਨ ਗੁਰਦਾਸਪੁਰ ਤੋਂ ਬੋਲਦੀ ਪਈ ਹਾਂ ਅਤੇ ਮਤਲਬ ਮੇਰੀ ਭਤੀਜੀ ਹੈਗੀ ਮੇਰਾ ਮਤਲਬ ਅਸੀਂ ਮਤਲਬ ਉਹਦਾ ਮਨ ਕਰ ਰਿਹਾ ਸੀ ਕਿ ਅਸੀਂ ਕਿਤੇ ਮਨੋਰੰਜਨ ਪਾਰਕ ਵਿੱਚ ਮਤਲਬ ਜਾਈਏ ਮਨੋਰੰਜਨ ਵੱਲ ਜਾਈਏ ਅਤੇ ਸਾਡੀ ਮਤਲਬ ਹੌਲੀ ਹੌਲੀ ਸਾਡੀ ਉਹਦੇ ਨਾਲ ਮੇਰੀ ਸਲਾਹ ਬਣ ਗਈ ਫਿਰ ਅਸੀਂ ਕੀ ਕੀਤਾ ਅਸੀਂ ਸਭ ਤੋਂ ਪਹਿਲਾਂ ਅਸੀਂ ਇਹਦੀਆਂ ਟਿਕਟਾਂ ਬੁੱਕ ਕੀਤੀਆਂ ਹਾਂਜੀ ਉਹਦੀਆਂ ਟਿਕਟਾਂ ਬੁੱਕ ਕੀਤੀਆਂ ਅਸੀਂ ਅਤੇ ਉਹਦੀਆਂ ਟਿਕਟਾਂ ਬੁੱਕ ਕਰਕੇ ਉਹ ਟਿਕਟਾਂ ਸਾਨੂੰ ਮਤਲਬ ਇੱਕ ਪਰ ਟਿਕਟ ਜਿਹੜੀ ਸੀ ਸਾਨੂੰ ਸਾਢੇ ਸੱਤ ਸੌ ਦੀ ਪਈ ਸੀ ਅਤੇ ਅਸੀਂ ਮਤਲਬ ਸਾਰਿਆਂ ਨੇ ਅਸੀਂ ਮਿਲ ਕੇ ਹੀ ਇੱਥੇ ਪਾਰਕ ਵਿੱਚ ਗਏ ਉੱਥੇ ਜਾ ਕੇ ਅਸੀਂ ਟਿਕਟਾਂ ਲਈਆਂ ਸਭ ਤੋਂ ਪਹਿਲਾਂ ਬਹੁਤ ਵਧੀਆ ਸੀਗਾ ਅਤੇ ਉਹਨਾਂ ਦੇ ਮਤਲਵ ਅਸੀਂ ਟਿਕਟਾਂ ਲੈ ਕੇ ਫਿਰ ਜਿਹੜੀਆਂ ਉਸ ਤੋਂ ਬਾਅਦ ਅਸੀਂ ਮਤਲਬ ਅਸੀਂ ਵਾਟਰ ਪਾਰਕ ਵਿੱਚ ਜਾਣ ਲਈ ਅਸੀਂ ਕੋਸਟਮ ਉੱਥੇ ਖਰੀਦੇ ਉਹ ਕੋਸਟਮ ਜਿਹੜੇ ਸੀ ਥੋੜੇ ਜਿਹੇ ਮਤਲਵ ਉਹ ਵੀ ਹੰਡਰਡ ਪਰ ਹੰਡਰਡ ਵੀ ਸੀ ਕੋਸਟਮ ਸੀਗਾ ਉੱਥੇ ਅਸੀਂ ਉਹ ਲਏ ਫਿਰ ਅਸੀਂ ਮਤਲਵ ਪਾਰਕ ਵਿੱਚ ਅਸੀਂ ਐਂਟਰੀ ਦਿੱਤੀ ਫਿਰ ਅਸੀਂ ਸਬਸੇ ਪਹਿਲੇ ਅਹੀਂ ਉਹਨਾਂ ਵਿੱਚ ਵੋਟਰ ਪਾਰਕ ਜਿਹੜੇ ਹੈਗੇ ਆ ਮਤਲਬ ਉਹ ਵਾਲੇ ਉਸ ਸਿਲਾਈ ਇੱਥੇ ਇੰਟਰਟੇਨਮੈਂਟ ਕੀਤਾ ਹੈਗਾ ਵਾਟਰ ਵਿੱਚ ਬੱਚਿਆਂ ਨੇ ਵੀ ਬਹੁਤ ਸਾਰਾ ਮੀਨਸ ਬਹੁਤ ਸਾਰਾ ਇੰਟਰਟੇਨਮੈਂਟ ਕੀਤਾ ਫਿਰ ਅਸੀਂ ਉੱਥੇ ਮਤਲਬ ਜਿੰਨੇ ਵੀ ਮਤਲਬ ਉੱਥੇ ਖਾਣ ਪੀਣ ਦਾ ਬਹੁਤ ਵਧੀਆ ਪ੍ਰੋਗਰਾਮ ਸੀਗਾ ਅੰਦਰ ਵਾਟਰ ਪਾਰਕ ਦੇ ਅੰਦਰ ਖਾਣ ਦਾ ਅਰੇਂਜਮੈਂਟ ਵੀ ਸੀਗਾ ਅਸੀਂ ਉੱਥੇ ਜਾ ਕੇ ਮਤਲਬ ਅ ਜਿਹੜਾ ਅੰਦਰ ਬਣਦੇ ਸੀ ਉਹ 'ਚ ਸਾਨੂੰ ਮਤਲਬ ਖਾਣਾ ਜਿਹੜਾ ਬਹੁਤ ਵਧੀਆ ਮਿਲਿਆ ਮਤਲਬ ਉੱਥੇ ਜਾ ਕੇ ਮਤਲਬ ਬਹੁਤ ਵਧੀਆ ਲੱਗਿਆ ਉੱਥੇ ਬਹੁਤ ਸਾਰਾ ਇੰਜੋਏਮੈਂਟ ਕੀਤਾ ਅਤੇ ਇੰਜੋਏਮੈਂਟ ਦੇ ਨਾਲ ਨਾਲ ਅਸੀਂ ਬਹੁਤ ਸਾਰੇ ਇੱਥੇ ਪਿਕਸ ਵਗੈਰਾ ਵੀ ਖਿੱਚੀਆਂ ਅਤੇ ਉਹਦੇ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ